ਹਾਂਜੀ ਮੈਂ ਯਾਤਰੀ ਬੱਸ ਦਾ ਜਿਹੜਾ ਵਰਣਨ ਆ ਉਹ ਕਰ ਸਕਦੀ ਹਾਂ ਕਿਉਂਕਿ ਮੈਂ ਖੁਦ ਯਾਤਰੀ ਬੱਸ ਦੇ ਵਿੱਚ ਕਈ ਵਾਰੀ ਸਫ਼ਰ ਕੀਤਾ ਮੈਂ ਪਿਛਲੇ ਸਾਲ ਦਾ ਜਿਹੜਾ ਸਫ਼ਰ ਸੀ ਉਹ ਤੁਹਾਡੇ ਨਾਲ ਸਾਂਝਾ ਕਰਾਂਗੀ ਯਾਤਰੀ ਬੱਸਾਂ ਛੋਟੀਆਂ ਵੀ ਹੁੰਦੀਆਂ ਨੇ ਵੱਡੀਆਂ ਵੀ ਹੁੰਦੀਆਂ ਨੇ ਅਸੀਂ ਵੱਡੀ ਬੱਸ ਦੇ ਵਿੱਚ ਜਿਹੜੀ ਕਿ ਉਣੰਜਾ ਸੀਟਰ ਸੀਗੀ ਉਸ ਦੇ ਵਿੱਚ ਅਸੀਂ ਕਾਫ਼ੀ ਸਾਰੀਆਂ ਸਿੱਖ ਸੰਗਤਾਂ ਦੇ ਨਾਲ ਅਸੀਂ ਇਸ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਗਏ ਅਤੇ ਸਭ ਤੋਂ ਪਹਿਲਾਂ ਬੱਸ ਦੇ ਵਿੱਚ ਅੱਗੇ ਡਰਾਈਵਰ ਸੀਟ ਹੁੰਦੀ ਹੈ ਡਰਾਈਵਰ ਸੀਟ ਜੋ ਬੱਸ ਡਰਾਈਵਰ ਆ ਜਿਹੜਾ ਉਹ ਬੱਸ ਨੂੰ ਲੀਡ ਕਰਦਾ ਅਤੇ ਉਹਦੇ ਆਲੇ ਦੁਆਲੇ ਚਾਰ ਪਰਸਨ ਨੇ ਜਿਹੜੇ ਹੋਰ ਬਹਿ ਸਕਦੇ ਨੇ ਅਤੇ ਨਾਲ ਹੀ ਪਿੱਛੇ ਜਿਹੜੀਆਂ ਉਣੰਜਾ ਸੀਟਰ ਬੱਸ ਅਸੀਂ ਛਿਆਲੀ ਵਿਅਕਤੀ ਸੀਗੇ ਜਿਹੜੇ ਅਸੀਂ ਉਸ ਬੱਸ ਦੇ ਵਿੱਚ ਗਏ ਅਤੇ ਬੜਾ ਇੰਜੋਏ ਕੀਤਾ ਜੀ ਅਤੇ ਬੱਸ ਦੇ ਵਿੱਚ ਸਪੀਕਰ ਲੱਗਿਆ ਹੋਇਆ ਸੀ ਅਤੇ ਧਾਰਮਿਕ ਜਿਹੜੇ ਸ਼ਬਦ ਨੇ ਉਹ ਸੁਣਦੇ ਸੁਣਾਉਂਦੇ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਅਤੇ ਜਿਹੜੀ ਇਸ ਇਹ ਬੱਸ ਸੀ ਸਪੈਸ਼ਲ ਅਨੰਦਪੁਰ ਸਾਹਿਬ ਲਈ ਜਾਂ ਅ ਕੀਤੀ ਹੋਈ ਸੀ ਅਤੇ ਅਸੀਂ ਰਸਤੇ ਵਿੱਚ ਕਿਤੇ ਵੀ ਰੁਕ ਸਕਦੇ ਸੀ ਰਸਤੇ ਦੇ ਵਿੱਚ ਜਿਹੜੇ ਗੁਰੂਧਾਮ ਆ ਰਹੇ ਸੀ ਅਸੀਂ ਉਹਨਾਂ ਦੇ ਦਰਸ਼ਨ ਕਰਦੇ ਹੋਏ ਅੱਗੇ ਵਧੇ ਜਿਹੜੇ ਡਰਾਈਵਰ ਸੀ ਉਹ ਵੀ ਬਹੁਤ ਵਧੀਆ ਸੀਗੇ ਅਤੇ ਜਿਹੜਾ ਸਾਡਾ ਸਫ਼ਰ ਸੀ ਕਾਫ਼ੀ ਕਾਫ਼ੀ ਆਨੰਦ ਨਾਲ ਅਸੀਂ ਗਏ ਅਤੇ ਬਹੁਤ ਵਧੀਆ ਰਿਹਾ ਜੀ